ਇਹ ਪੌਦੇ ਉਗਾਉਣ ਲਈ ਸਾਨੂੰ ਲਾਲ ਮਿੱਟੀ ਦੀ ਜਾਂ ਪੋਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਅਸੀਂ ਨਹਿਰ ਦੇ ਵਿੱਚੋਂ ਮਿੱਟੀ ਲਿਆ ਕੇ ਬੂਟੇ ਲਾ ਸਕਦੇ ਹਾਂ ਜਿਸ ਨੂੰ ਪਲ ਵੀ ਕਿਹਾ ਜਾਂਦਾ ਹੈ ਇਹ ਮਿੱਟੀ ਪੌਦਿਆਂ ਵਾਸਤੇ ਬਹੁਤ ਹੀ ਗੁਣਕਾਰੀ ਹੁੰਦੀ ਹੈ ਇਹਦੇ ਵਿੱਚ ਪੌਦਿਆਂ ਨੂੰ ਵਧਣ ਫੁੱਲਣ ਦਾ ਪੂਰੇ ਪੌਸ਼ਟਿਕ ਤੱਤ ਮਿਲਦੇ ਹਨ ਅਸੀਂ ਪੌਦਿਆਂ ਲਈ ਵੱਖ ਵੱਖ ਤਰ੍ਹਾਂ ਦੀਆਂ ਖਾਦਾਂ ਦਾ ਵੀ ਉਪਯੋਗ ਕੀਤਾ ਜਾਂਦਾ ਹੈ ਜਿਸ ਕਰਕੇ ਜੋ ਉਹਨਾਂ ਨੂੰ ਕਮੀਆਂ ਹੁੰਦੀਆਂ ਹਨ ਉਸ ਲਈ ਉਹਨਾਂ ਨੂੰ ਖਾਦਾਂ ਵੀ ਪਾਈਆਂ ਜਾਂਦੀਆਂ ਹਨ ਅਸੀਂ ਖਾਦ ਘਰੇਲੂ ਵਰਤਦੇ ਹਾਂ ਜਿਸ ਤਰ੍ਹਾਂ ਕੋਈ ਸਬਜ਼ੀਆਂ ਦੇ ਛਿਲਕੇ ਹੋ ਗਏ ਜਾਂ ਕੋਈ ਫਰੂਟ ਦੇ ਫਲਾਂ ਦੇ ਛਿਲਕੇ ਹੋ ਗਏ ਜਾਂ ਚਾਹ ਪੱਤੀ ਦਾ ਜੋ ਬਚਿਆ ਹੁੰਦਾ ਉਹਨੂੰ ਪਾ ਕੇ ਅਸੀਂ ਖਾਦ ਬਣਾ ਲੈਂਦੇ ਹਾਂ